ਮੇਰੇ ਹਿਸਾਬ ਨਾਲ ਨਾਗਰਿਕਾਂ ਦੀ ਸੁਰੱਖਿਆ ਅਤੇ ਸਮਾਜ ਵਿੱਚ ਸ਼ਾਂਤੀ ਬਣਾਏ ਰੱਖਣ ਦੇ ਲਈ ਸਾਡੀ ਜੋ ਪੰਜਾਬ ਪੁਲਿਸ ਆ ਉਹ ਉਸ ਨੂੰ ਵਰਕ ਕਰਨਾ ਚਾਹੀਦਾ ਹੈ ਚੰਗੀ ਤਰ੍ਹਾਂ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਉਹ ਵਧੀਆ ਤਰੀਕੇ ਨਾਲ ਵਰਕ ਨਹੀਂ ਕਰਦੀ ਹੈਗੀ ਤਾਂ ਹੀ ਸਾਡਾ ਜਿਹੜਾ ਹੈ ਉਹ ਸੁਰੱਖਿਆ ਪ੍ਰੋਪਰ ਨਹੀਂ ਹੈ ਅਸੀਂ ਸਗੋਂ ਉਹਨਾਂ ਦੇ ਕੋਲ ਜੇ ਸਾਨੂੰ ਕਿਸੇ ਵੀ ਤਰ੍ਹਾਂ ਨਾਗਰਿਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਤਾਂ ਅ ਸਾਨ ਸਾਨੂੰ ਇਹ ਫੀਲ ਹੋਣਾ ਚਾਹੀਦਾ ਕਿ ਹਾਂ ਅਸੀਂ ਅਗਰ ਪੰਜਾਬ ਪੁਲਿਸ ਕੋਲ ਜਾਵਂਗੇ ਤਾਂ ਸਾਨੂੰ ਇੱਕ ਅੱਛਾ ਰੈਜੋਲਿਊਸ਼ਨ ਮਿਲੇਗਾ ਔਰ ਉਹ ਸਾਡੀ ਸੇਫਟੀ ਦੇ ਲਈ ਖੜੇ ਨੇ ਬਟ ਬ ਸਾਨੂੰ ਕਦੇ ਵੀ ਇੱਦਾਂ ਦਾ ਫੀਲ ਆਉਂਦਾ ਨਹੀਂ ਹੈ ਇਹ ਹੁੰਦਾ ਹੈ ਕੇ ਯਾਰ ਜੇ ਪੁਲਿਸ ਕੋਲ ਗਏ ਤਾਂ ਉਹਨਾਂ ਨੇ ਤਾਂ ਸਗੋਂ ਏ ਸਾਨੂੰ ਜ਼ਿਆਦਾ ਦੁਖੀ ਕਰਨਾ ਅਤੇ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿੱਥੋਂ ਤੱਕ ਮੈਨੂੰ ਲੱਗਦਾ ਔਰ ਸਮਾਜ ਵਿੱਚ ਸ਼ਾਂਤੀ ਮੈਨੂੰ ਲੱਗਦਾ ਕੇ ਥੋਟ ਪ੍ਰੋਸੈਸਿਸ ਜਿਹੜੇ ਨੇ ਉਹਨਾਂ ਦੀ ਅਵੇਅਰਨੈਸ ਅਗਰ ਹੋਵੇਗੀ ਤਾਂ ਜ਼ਿਆਦਾ ਹੋਵੇਗੀ ਲੋਕ ਮੋਸਟਲੀ ਹਜੇ ਵੀ ਕੁਝ ਚੀਜ਼ਾਂ ਦੇ ਵਿੱਚ ਉਲਝੇ ਹੋਏ ਨੇ ਖਾਸ ਕਰਕੇ ਧਰਮ ਜਾਤੀਆਂ ਦੇ ਵਿੱਚ ਜਦੋਂ ਤੱਕ ਉਹਨਾਂ ਨੂੰ ਇਹ ਹੀ ਨਹੀਂ ਸਮਝਣਗੇ ਕਿ ਪਰਮਾਤਮਾ ਇੱਕ ਹੀ ਹੈ ਅਤੇ ਇਹ ਜਿਹੜੇ ਲੋਕ ਇੱਥੇ ਬੈਠੇ ਨੇ ਉਹ ਸਿਰਫ ਔਰ ਸਿਰਫ ਉਹਨਾਂ ਚੀਜ਼ਾਂ ਦਾ ਫ਼ਾਇਦਾ ਉਠਾਉਂਦੇ ਨੇ ਕਿ ਹਾਂ ਤੁਸੀਂ ਸਿੱਖ ਹੋ ਤੁਸੀਂ ਮੁਸਲਮਾਨ ਹੋ ਤਾਂ ਉਦੋਂ ਤੱਕ ਸਮਾਜ ਵਿੱਚ ਕਦੇ ਵੀ ਸਾਂਤੀ ਨਹੀਂ ਰਹਿ ਸਕਦੀ ਆਪਣੇ ਆਪਣੇ ਥੋਟ ਪ੍ਰੋਸੈਸਿਸ ਜਿਹੜੇ ਨੇ ਉਹ ਇੰਪਰੂਵ ਹੋਣੇ ਚਾਹੀਦੇ ਨੇ ਅਤੇ ਜੇ ਤੁਸੀਂ ਅਪਰਾਧ ਦਰ ਦੀ ਗੱਲ ਕਰਦੇ ਹੋ ਤਾਂ ਇਹਦੇ ਲਈ ਤਾਂ ਰੂਲਸ ਐਂਡ ਰੈਗੂਲੇਸ਼ਨ ਥੋੜ੍ਹੇ ਜਿਹੇ ਜ਼ਿਆਦਾ ਸਟਰਿਕਟ ਹੋ ਜਾਣੇ ਚਾਹੀਦੇ ਨੇ ਕਿ ਜੇ ਕੋਈ ਵੀ ਚੋਰੀ ਕਰਦਾ ਹੋਇਆ ਅਤੇ ਚੋਰੀ ਦੇ ਲਈ ਫੜਿਆਂ ਜਾਂਦਾ ਤਾਂ ਉਹਨੂੰ ਜੇਲ੍ਹ ਜਾਂ ਕੁਛ ਇੱਦਾਂ ਦਾ ਨਹੀਂ ਜਿੱਦਾਂ ਦੁਬਈ ਦੇ ਵਿੱਚ ਬਾਹਰਲੇ ਦੇਸ਼ਾਂ ਦੇ ਵਿੱਚ ਰੂਲਸ ਹੈਗੇ ਨੇ ਕਿ ਉਹਨਾਂ ਦੇ ਫਿਰ ਹੱਥ ਜਿਹੜੇ ਆ ਉਸੇ ਵੇਲੇ ਵੱਢ ਦਿਓ ਤਾਂ ਉੱਦਾਂ ਹੀ ਹੈ ਤੇ ਜੇ ਕੋਈ ਹੋਰ ਕਿਸੇ ਤਰ੍ਹਾਂ ਦਾ ਅਪਰਾਧ ਜੇ ਕੋਈ ਕਤਲ ਕਰਦਾ ਤਾਂ ਉਹਨੂੰ ਫਾਂਸੀ ਹੀ ਹੋ ਜਾਣੀ ਚਾਹੀਦੀ ਹੈ ਸਿੱਧੀ ਉਹ ਵੀ ਲੋਕਾਂ ਦੇ ਸਾਹਮਣੇ ਸੋ ਦੈਟ ਕਿ ਅਗਰ ਕਦੇ ਵੀ ਇੱਦਾਂ ਦੇ ਕੋਈ ਅਪਰਾਧ ਹੁੰਦੇ ਨੇ ਤਾਂ ਉਹਨਾਂ ਦੇ ਔਨ ਦੀ ਸਪੋਟ ਸਲਿਊਸ਼ਨਸ ਹੋਣਗੇ ਤਾਂ ਤਾਂਹੀ ਔਰ ਇੱਕ ਇਹ ਵੀ ਹੋਣਾ ਚਾਹੀਦਾ ਹੈ ਕਿ ਜੇ ਕੋਈ ਵੀ ਅਪਰਾਧ ਕਰ ਰਿਹਾ ਹੈ ਇਹ ਨਹੀਂ ਹੈ ਕਿ ਜੇ ਉਹ ਮੰਤਰੀ ਦਾ ਬੱਚਾ ਹੈ ਤਾਂ ਜਾਂ ਮੰਤਰੀ ਹੈ ਤਾਂ ਉਹਨੂੰ ਕੁਛ ਨਹੀਂ ਕਹਿਣਾ ਔਰ ਜੇ ਕੋਈ ਗਰੀਬ ਹੈ ਵਿਚਾਰਾ ਤਾਂ ਉਹਦਾ ਬੁਰਾ ਹਾਲ ਕਰ ਦੇਣਾ ਤੋ ਇਸ ਲਈ ਮੈਨੂੰ ਲੱਗਦਾ ਕਿ ਕਾਨੂੰਨੀ ਜੋ ਉਹਨਾਂ ਦੀਆਂ ਫਾਈਲਸ ਨੇ ਜਾਂ ਜੋ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਵਾਲੀਆਂ ਬੁੱਕਸ ਨੇ ਉਹਨਾਂ ਦੇ ਵਿੱਚ ਚੇਂਜਿਸ ਜ਼ਰੂਰ ਹੋਣੇ ਚਾਹੀਦੇ ਹੈ ਜੇ ਕਿਰਨ ਬੇਦੀ ਵਰਗੀ ਔਫੀਸਰ ਹੋਕੇ ਅਤੇ ਚੰਡੀਗੜ੍ਹ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਹੋ ਸਕਦੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੀ ਉਹ ਰੂਲਸ ਐਂਡ ਰੈਗੂਲੇਸ਼ਨਸ ਫੋਲੋ ਹੋ ਸਕਦੇ ਨੇ ਬਸ ਡੈਟਸ ਇੱਟ ਫਰੋਮ ਮਾਏ ਸਾਈਡ ਥੈਂਕ ਯੂ